ਮੈਂ ਪੰਜਾਬ ਸ਼ਹਿਰ ਦੇ ਵਿੱਚ ਰਹਿਣ ਵਾਲਾ ਨਿਵਾਸੀ ਹਾਂ ਮੇਰੇ ਮੁਤਾਬਿਕ ਜਦੋਂ ਮੈਂ ਛੁੱਟੀਆਂ ਜਾਂਦਾ ਹਾਂ ਤਾਂ ਆਪਣੇ ਮੈਂ ਪਿੰਡ ਵਾਲੇ ਘਰ ਜਾਂਦਾ ਹਾਂ ਜਿੱਥੇ ਮੇਰਾ ਆਪਣਾ ਇੱਕ ਸਾਡਾ ਘਰ ਹੁੰਦਾ ਹੈ ਅਤੇ ਨਾਲ ਉਸ ਅਤੇ ਨਾਲ ਇਹ ਖੇਤ ਹੁੰਦਾ ਹੈ ਛੁੱਟੀਆਂ ਵਾਲੇ ਦਿਨ ਜਾਂ ਛੁੱਟੀਆਂ ਵਿੱਚ ਮੈਂ ਆਪਣੇ ਪਿੰਡ ਵਾਲੇ ਘਰ 'ਚ ਜਾਣਾ ਪਸੰਦ ਕਰਦਾ ਹਾਂ ਕਿਉਂਕਿ ਉੱਥੇ ਸਭ ਤੋਂ ਪਹਿਲਾਂ ਇੱਕ ਸ਼ਾਂਤੀ ਬਹੁਤ ਹੁੰਦੀ ਹੈ ਪੰਜਾਬ ਉੱਥੇ ਪਿੰਡਾਂ ਦਾ ਵਾਤਾਵਰਣ ਸ਼ੁੱਧ ਹੁੰਦਾ ਹੈ ਉੱਥੇ ਸਵੇਰ ਦਾ ਨਜ਼ਾਰਾ ਦੇਖਣ ਯੋਗ ਹੁੰਦਾ ਹੈ ਅਤੇ ਖੇਤਾਂ ਵਿੱਚ ਘੁੰਮਣ ਦਾ ਨਜ਼ਾਰਾ ਬਹੁਤ ਵਧੀਆ ਹੁੰਦਾ ਹੈ ਗਰਮੀਆਂ ਵਿੱਚ ਤਾਂ ਜ਼ਰੂਰ ਹੀ ਮੈਂ ਆਪਣੇ ਪਿੰਡ ਵਾਲੇ ਘਰ ਜਾਂਦਾ ਹਾਂ ਕਿਉਂਕਿ ਉੱਥੇ ਜੋ ਪਾਣੀ ਦਾ ਵਹਾਅ ਹੁੰਦਾ ਹੈ ਅਤੇ ਉਸ ਵਿੱਚ ਨਹਾਉਣ ਦਾ ਮਜਾ ਹੀ ਹੈ ਅਲੱਗ ਹੁੰਦਾ ਹੈ ਛੁੱਟੀਆਂ ਵਾਲੇ ਘਰ ਵਿੱਚ ਮੈਂ ਹਮੇਸ਼ਾ ਹੀ ਛੁੱਟੀਆਂ ਦੇ ਵਿੱਚ ਹੀ ਜਾਂਦਾ ਹਾਂ ਜੇ ਘਰ ਵਿੱਚ ਕੋਈ ਹੋਵੇ ਜਾਂ ਨਾ ਹੋਵੇ ਮੈਂ ਛੁੱਟੀਆਂ ਵਿੱਚ ਹੀ ਪਿੰਡਾਂ ਵਾਲੇ ਘਰ ਵਿੱਚ ਜਾਂਦਾ ਹਾਂ ਪਿੰਡ ਦਾ ਘਰ ਸਭ ਤੋਂ ਵਧੀਆ ਅਤੇ ਸ਼ਾਂਤਮਈ ਇਲਾਕੇ ਵਿੱਚ ਹੈ ਜਿਸ ਨਾਲ ਕਿ ਸਾਨੂੰ ਸਾਰਾ ਪਰਿਵਾਰ ਜਾਣਾ ਉੱਥੇ ਪਸੰਦ ਕਰਦਾ ਹੈ ਉੱਥੇ ਸ਼ਾਮ ਦੀ ਸੈਰ ਤੋਂ ਲੈ ਕੇ ਸਵੇਰ ਦੀ ਸੈਰ ਤੱਕ ਦਾ ਨਜ਼ਾਰਾ ਬਹੁਤ ਹੀ ਅਲੱਗ ਹੁੰਦਾ ਹੈ ਸਾਰੇ ਲੋਕ ਉੱਥੇ ਮਿਲਣਸਾਰ ਵਾਲੇ ਹੁੰਦੇ ਹਨ ਅਤੇ ਸਾਰਿਆਂ ਦੇ ਘਰ ਜਦੋਂ ਮਰਜੀ ਆ ਜਾ ਸਕਦੇ ਹਨ ਪਿੰਡਾਂ ਦਾ ਖਾਣਾ ਬਹੁਤ ਸ਼ੁੱਧ ਹੁੰਦਾ ਹੈ ਇਸ ਕਰਕੇ ਅਸੀਂ ਉੱਥੇ ਹੀ ਜਾਣਾ ਛੁੱਟੀਆਂ ਵਿੱਚ ਮਹਿਸੂਸ ਕਰਦੇ ਹਨ ਅਤੇ ਉੱਥੇ ਛੁੱਟੀਆਂ ਬਤੀਤ ਕਰਦੇ